ਟੈਕਨੋਲਜੀ ਇਕ ਬਹੁਤ ਵੱਡਾ ਨੌਕਰੀਆਂ ਦਾ ਜਾਂ ਰੋਜ਼ਗਾਰ ਦਾ ਸਾਧਨ ਹੈ ਜਿਸ ਨੇ ਲੋਕਾਂ ਦੀ ਬਹੁਤ ਹੀ ਮਦਦ ਕੀਤੀ ਹੈ ਟੈਕਨੋਲੋਜੀ ਦੇ ਨਾਲ ਹੀ ਲੋਕਾਂ ਨੂੰ ਇੰਨੀ ਨੌਕਰੀਆਂ ਮਿਲੀਆਂ ਹਨ ਜਿਵੇਂ ਕਿ ਕਲਰਕ ਦੀ ਨੌਕਰੀ ਹੋ ਗਈ ਕੋਈ ਵੀ ਆਪਾਂ ਸਟਾਮ ਪੇਪਰ ਲੈਣਾ ਹੈ ਤਾਂ ਉਹ ਵੀ ਆਪਾਂ ਨੂੰ ਟਾਈਪ ਕਰਕੇ ਮਿਲਦਾ ਹੈ ਉਹ ਵੀ ਇੱਕ ਟੈਕਨੋਲੋਜੀ ਦੇ ਅਕੋਰਡਿੰਗ ਹੀ ਹੋਇਆ ਹੈ ਆਪਣੇ ਪਰ ਬਹੁਤ ਹੀ ਨੌਕਰੀਆਂ ਨੇ ਇੱਦਾਂ ਦੀਆਂ ਜੋ ਕਿ ਟੈਕਨੋਲੋਜੀ ਦੇ ਬੇਸ 'ਤੇ ਹਨ ਜੇ ਸਕੂਲ ਵਿੱਚ ਕਲਰਕ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਕੰਪਿਊਟਰ ਬੇਸਡ ਹੀ ਸਾਰੀਆਂ ਸਲਿਪ ਵਗੈਰਾ ਕੱਟ ਕੇ ਦਿੰਦੇ ਹਨ ਫੀਸਾਂ ਦੀਆਂ ਜੇ ਗੱਲ ਕੀਤੀ ਜਾਵੇ ਕਿਸੇ ਨਾਲ ਗੱਲ ਕਰਨ ਦੀ ਜਾਂ ਆਪਾਂ ਇੰਟਰਨੈਟ ਤੋਂ ਕੁਛ ਵੀ ਕਢਵਾਣਾ ਹੋਵੇ ਤਾਂ ਉਸ ਲਈ ਵੀ ਇੱਕ ਅਲੱਗ ਤੋਂ ਅਕੈਡਮੀਆਂ ਬਣ ਚੁਕੀਆਂ ਹਨ ਜਿੱਥੇ ਸ਼ਿਰਫ ਟੈਕਨੋਲੋਜੀ ਦਾ ਹੀ ਇਸਤੇਮਾਲ ਕੀਤਾ ਜਾਂਦਾ ਹੈ ਜੇ ਇੱਕ ਬੰਦਾ ਟੈਕਨੋਲੋਜੀ ਦਾ ਕੰਮ ਸ਼ੁਰੂ ਕਰਦਾ ਹੈ ਤਾਂ ਉਹ ਦਸ ਬੰਦਿਆਂ ਨੂੰ ਹੋਰ ਨੌਕਰੀ 'ਤੇ ਰੱਖਦਾ ਹੈ ਟੈਕਨੋਲੋਜੀ ਨੇ ਲੋਕਾਂ ਨੂੰ ਰੋਜ਼ਗਾਰ ਦੇ ਕੇ ਬਹੁਤ ਵਧੀਆ ਕੰਮ ਕੀਤਾ ਹੈ ਧੰਨਵਾਦ